ਇੱਕ ਵਾਰੀ ਮੈਂ ਸਕੂਲ ਵਿੱਚ ਇੱਕ ਕਲਾ ਬਣਾਈ ਸੀਗੀ ਜੋ ਕਿ ਮੇਰੀ ਡਰਾਇੰਗ ਟੀਚਰ ਨੇ ਮੈਨੂੰ ਦਿੱਤੀ ਸੀਗੀ ਅਤੇ ਮੇਰੀ ਪ੍ਰੇਰਨਾ ਇਹ ਸੀਗੀ ਕਿ ਉਹ ਕੋਈ ਨੈਚੁਰਲ ਚੀਜ਼ ਹੋਵੇ ਜਿਵੇਂ ਕਿ ਕੋਈ ਪਕਸ਼ੀ ਪੰਛੀ ਜਾਂ ਕੋਈ ਸੀਨਰੀ ਅਤੇ ਇਸ ਤਰ੍ਹਾਂ ਮੈਂ ਮੋਰ ਦੀ ਇੱਕ ਬਹੁਤ ਵੱਡੀ ਪੇਂਟਿੰਗ ਬਣਾਈ ਸੀਗੀ ਜੋ ਕਿ ਰੀਸਾਈਕਲ ਕਾਗਜ਼ਾਂ ਅਤੇ ਕਤਰਨਾ ਤੋਂ ਜੋੜ ਕੇ ਬਣਾਈ ਗਈ ਸੀਗੀ ਅਤੇ ਇਸ ਨੂੰ ਬਣਾਉਂਦੇ ਸਮੇਂ ਮੈਨੂੰ ਚੁਣੌਤੀਆਂ ਜ਼ਿਆਦਾ ਇਹ ਆਈਆਂ ਸੀਗੀ ਕਿਉਂਕਿ ਕਲਰ ਕੋਂਬੀਨੇਸ਼ਨ ਕਰਨਾ ਬਹੁਤ ਔਖਾ ਹੁੰਦਾ ਸੀਗਾ ਉਸ ਤੋਂ ਬਾਅਦ ਇਹਨਾਂ ਦੇ ਟੁਕੜਿਆਂ ਨੂੰ ਛੋਟੇ ਛੋਟੇ ਕਰਕੇ ਇੱਕ ਜਗ੍ਹਾ 'ਤੇ ਸਜਾਉਣਾ ਅਤੇ ਆਪਣੇ ਮਨ ਚਾਹਾ ਆਕਾਰ ਦੇਣਾ ਜੋ ਕਿ ਬਹੁਤ ਆਸਾਨ ਨਹੀਂ ਹੁੰਦਾ ਹੈ